ਮੈਂ ਸਿਲਾਈ ਸੈਂਟਰ ਤੋਂ ਸਿੱਖੀ ਸੀ ਸਾਡੇ ਪਿੰਡ ਵਿੱਚ ਮੁਫ਼ਤ ਸਿਲਾਈ ਸੈਂਟਰ ਆਇਆ ਹੋਇਆ ਸੀਗਾ ਅਤੇ ਉੱਥੇ ਜਾ ਕੇ ਮੈਂ ਆਪਣੀ ਜਿਹੜੀ ਸਿਲਾਈ ਦਾ ਕੰਮ ਸਿੱਖਿਆ ਸੀ ਉੱਥੇ ਸਾਨੂੰ ਬਹੁਤ ਸਾਰੀ ਚੀਜ਼ਾਂ ਸਿਖਾਉਂਦੇ ਸੀ ਜਿਵੇਂ ਲਾਈਨਿੰਗ ਵਾਲ਼ੇ ਸੂਟ ਹੋ ਗਏ ਸਿੰਪਲ ਸੂਟ ਹੋ ਗਏ ਪਲਾਜ਼ੋ ਵਗੈਰਾ ਹੋ ਗਏ ਅੱਛਾ ਫਰਾਕ ਫਰੋਕਸ ਵਗੈਰਾ ਹੋ ਗਈਆਂ ਇਹ ਸਾਰੀਆਂ ਚੀਜ਼ਾਂ ਉੱਥੇ ਬਹੁਤ ਅੱਛੇ ਤਰੀਕੇ ਨਾਲ਼ ਸਿਖਾਉਂਦੇ ਸੀਗੇ ਉਸ ਤੋਂ ਬਾਅਦ ਸਕੀਮ ਵੀ ਆਈ ਸੀਗੀ ਜਿਹਦੇ ਵਿੱਚ ਸਾਨੂੰ ਜਿਹੜੀ ਹੈ ਇਹ ਸਨਮਾਨ ਵਜੋਂ ਮੁਫ਼ਤ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ ਸੀ ਸਰਕਾਰ ਵੱਲੋਂ